ਟੈਕਨੋਲਜੀ ਦਾ ਸਾਡੇ ਜੀਵਨ 'ਤੇ ਮਨੁੱਖੀ ਜੀਵਨ 'ਤੇ ਬਹੁਤ ਜ਼ਿਆਦਾ ਪ੍ਰਭਾਵ ਪਾ ਰਹੀ ਹੈਗੀ ਇਹਦੇ ਵਿੱਚ ਜਿਹੜਾ ਸ ਸਪੈਸ਼ਲੀ ਜਿਹੜਾ ਸਮਾਰਟਫੋਨ ਹੈਗਾ ਹੈ ਸਮਾਰਟਫੋਨ ਜਿਹੜਾ ਸਾਡੀ ਜ਼ਿੰਦਗੀ 'ਤੇ ਬਹੁਤ ਜ਼ਿਆਦਾ ਵ ਪ੍ਰਭਾਵ ਪਾ ਰਿਹਾ ਇਹਨੂੰ ਬਿਹਤਰ ਬਣਾ ਰਿਹਾ ਹੈਗਾ ਜਿੱਦਾਂ ਆਪਾਂ ਦੇਖਿਆ ਜਾ ਸਕਦਾ ਹੈਗਾ ਹੈ ਵੀ ਜਿੱਦਾਂ ਪਹਿਲਾਂ ਆਪਾਂ ਦੇਖਿਆ ਜਾ ਸਕਦਾ ਜਿੱਦਾਂ ਬੈਂਕਾਂ ਵਿੱਚ ਆਪਾਂ ਕੋਈ ਵੀ ਛੋਟਾ ਮੋਟਾ ਕੰਮ ਕਰਨਾ ਹੈਗਾ ਹੈ ਭਾਵੇਂ ਸਾਡਾ ਪੰਜ ਮਿੰਟ ਦਾ ਜਾਂ ਇੱਕ ਮਿੰਟ ਦਾ ਕੰਮ ਵੀ ਹੋਵੇ ਤਾਂ ਸਾਨੂੰ ਉਹਦੇ ਵਾਸਤੇ ਸਾਨੂੰ ਘੰਟੇ ਬੱਧੀ ਪਹਿਲਾਂ ਸਾਨੂੰ ਬੈਂਕਾਂ 'ਚ ਲਾਇਨਾਂ 'ਚ ਖੜ੍ਹੇ ਰਹਿਣਾ ਪੈਂਦਾ ਤਾਂ ਸਾਨੂੰ ਪੂਰਾ ਪੂਰਾ ਦਿਨ ਵੀ ਸਾਡਾ ਖਰਾਬ ਹੋ ਜਾਂਦਾ ਪੰਜ ਮਿੰਟ ਦੇ ਕੰਮ ਕਰਕੇ ਹੁਣ ਆਪਾਂ ਜਿੱਦਾਂ ਹੀ ਜਿੱਦਾਂ ਵੀ ਸਮਾਰਟਫੋਨ ਆ ਗਏ ਵੀ ਹੈਗੇ ਆ ਇਹਨੇ ਸਾਡੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਾਸਤੇ ਬੈਂਕਿੰਗ ਟਰਾਂਜੈਕਸ਼ਨਾਂ ਨੂੰ ਬਿਹਤਰ ਬਣਾਉਣ ਵਾਸਤੇ ਬਹੁਤ ਜ਼ਿਆਦਾ ਯੋਗਦਾਨ ਪਾਉਂਦਾ ਹੈਗਾ ਹੈ ਇੱਦਾਂ ਆਪਾਂ ਕੋਈ ਮੰਨ ਲਉ ਆਪਾਂ ਮੈਂ ਹੁਣ ਘਰ ਬਹਿ ਕੇ ਆਪਣਾ ਦੇਖਣਾ ਹੈ ਵੀ ਮੇਰੇ ਖਾਤੇ 'ਚ ਪੈਸੇ ਆਏ ਹੈਗੇ ਆ ਜਾਂ ਨਹੀਂ ਆਏ ਹੈਗੇ ਹੈ ਉਹਨੂੰ ਮੈਂ ਕਿੱਦਾਂ ਚੈੱਕ ਕਰ ਸਕਦਾ ਹੁਣ ਮੈਨੂੰ ਬੈਂਕ ਜਾਣ ਦੀ ਲੋੜ ਨਹੀਂ ਹੈਗੀ ਨਾ ਮੈਨੂੰ ਏ ਟੀ ਐਮ ਜਾਣ ਦੀ ਲੋੜ ਹੈ ਮੈਂ ਘਰ ਬੈਠੇ ਆਪਣੇ ਫੋਨ ਨਾਲ ਜਿਹੜਾ ਵੀ ਹੁੰਦਾ ਸਮਾਰਟਫੋਨ ਆ ਜਿਹੜਾ ਵੀ ਹੁੰਦਾ ਬੈਂਕ ਦਾ ਐਪ ਵਗੈਰਾ ਦੇਖ ਕੇ ਜਾਂ ਫਿਰ ਗੂਗਲ ਪੇ ਪੇਟੀਐਮ ਵਗੈਰਾ ਜੋ ਵੀ ਐਪ ਹੁੰਦੇ ਹੈਗੇ ਆ ਉਹਦੇ ਨਾਲ ਮੈਂ ਸਮਾਰਟਫੋਨ ਤੋਂ ਸਿੱਧਾ ਹੀ ਚੈੱਕ ਕਰ ਸਕਦਾ ਘਰ ਹੀ ਬੈਠੇ ਇੱਕ ਮਿੰਟ ਵੀ ਨਾ ਲੱਗਦਾ ਉਹਦੇ ਨਾਲ ਸਾਨੂੰ ਪਤਾ ਕਰਨ ਨੂੰ ਇਸ ਤੋਂ ਇਲਾਵਾ ਜਿਹੜਾ ਸਮਾਰਟਫੋਨ ਹੈਗਾ ਹੈ ਇਹਦੇ ਹੋਰ ਵੀ ਬਹੁਤ ਜ਼ਿਆਦਾ ਫਾਇਦੇ ਹੈਗੇ ਪਹਿਲਾਂ ਫੋਨ ਕਰਨ ਦੇ ਨਾਲ ਸੁਣਨ ਦੇ ਕੰਮ ਤਾਂ ਆਉਂਦਾ ਹੀ ਤਾ ਉਹਦੇ ਇਲਾਵਾ ਹੋਰ ਵੀ ਜਿੱਦਾਂ ਹੁਣ ਕਿਸੇ ਨੇ ਬੱਚੇ ਨੇ ਪੜ੍ਹਨਾ ਚਾਹੁੰਦਾ ਹੈਗਾ ਹੈ ਉਹ ਉਹਦੇ ਕੋਲ ਲੈਪਟੋਪ ਵਗੈਰਾ ਜਾਂ ਫਿਰ ਬਾਹਰ ਰਹਿਣ ਦੇ ਉਹ ਯੋਗ ਨਹੀਂ ਹੈਗਾ ਜਾਂ ਉਹਦਾ ਖਰਚਾ ਨਹੀਂ ਚੱਕ ਸਕਦਾ ਹੈਗਾ ਇਹ ਤਾਂ ਉਹਦੇ ਕਰਕੇ ਉਹ ਜਿਹੜਾ ਹੈਗਾ ਸਮਾਰਟਫੋਨ ਉਹਦੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਉਹਦੇ ਵਾਸਤੇ ਐਂ ਕਹਿੰਦੇ ਇੱਕ ਰੈਵੋਲਊਸ਼ਨਰੀ ਚੀਜ਼ ਹੈਗੀ ਆ ਇਹ ਉਹਦੇ ਨਾਲ ਕਿਆ ਹੈਗਾ ਕੋਈ ਵੀ ਚੀਜ਼ ਜਿਹੜੀ ਪੜ੍ਹਨੀ ਹੈਗੀ ਹੈ ਉਹ ਘਰ ਆਪਣੇ ਅੰਦਰ ਬਹਿ ਕੇ ਕੋਰਸ ਵਗੈਰਾ ਲਵੇ ਔਨਲਾਈਨ ਕਲਾਸਾਂ ਵਗੈਰਾ ਜੁਆਇਨ ਕਰਕੇ ਕੋਰਸਿਸ ਵਗੈਰਾ ਲੈ ਕੇ ਟੀਚਰਸ ਜਾਂ ਫਿਰ ਯੂਟੀਊਬ ਵਗੈਰਾ ਤੋਂ ਪੜ੍ਹ ਸਕਦਾ ਹੈਗਾ ਅਤੇ ਆਪਣੇ ਜੋ ਵੀ ਉਹ ਬਣਨਾ ਚਾਹੁੰਦਾ ਜਿ ਜਿਸ ਵੀ ਮੁਕਾਮ 'ਤੇ ਜ਼ਿੰਦਗੀ ਦੇ ਪਹੁੰਚਣਾ ਚਾਹੁੰਦਾ ਉੱਥੇ ਉਹ ਪਹੁੰਚ ਸਕਦਾ ਹੈਗਾ ਹੈ ਅਤੇ ਉਸ ਤੋਂ ਇਲਾਵਾ ਵੀ ਜਿਹੜੇ ਹੈਗੇ ਹੈ ਸੋਸ਼ਲ ਮੀਡੀਆ ਵਾਸਤੇ ਅਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਵਾਸਤੇ ਜਿਹੜਾ ਹੈਗਾ ਸਮਾਰਟਫੋਨ ਦਾ ਸਾਡੀ ਜ਼ਿੰਦਗੀ ਨੂੰ ਬਿਹਤਰ ਬਣਾਇਆ ਹੈਗਾ ਅਤੇ ਬੰਦੇ ਦਾ ਵਿਹਲੇ ਬੰਦੇ ਬੈਠੇ ਦਾ ਵਿਹਲੇ ਬੰਦੇ ਦਾ ਸਮਾਰਟਫੋਨ ਨਾਲ ਟਾਈਮ ਵੀ ਬਹੁਤ ਵਧੀਆ ਪਾਸ ਹੋ ਜਾਂਦਾ ਹੈਗਾ ਹੈ